ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਰੇਸ਼ਮ ਬੋਲ ਰਹੇ ਓਵਰ ਕੈਬ ਵਾਲੇ ਹਾਂਜੀ ਸਰ ਸਰ ਮੈਂ ਰੁਪਿੰਦਰ ਬੋਲ ਰਹੀ ਹਾਂ ਹਾਂਜੀ ਸਰ ਹਾਂਜੀ ਸਰ ਪਹਿਚਾਣ ਲਿਆ ਜਿਨ੍ਹਾਂ ਨੂੰ ਤੁਸੀਂ ਕੱਲ੍ਹ ਛੱਡਿਆ ਸੀ ਰੋਪੜ ਹਾਂਜੀ ਸਰ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇੱਕ ਨਵੇਂ ਸ਼ਹਿਰ 'ਚ ਛੱਡਿਆ ਕਿਉਂਕਿ ਮੈਨੂੰ ਨਹੀਂ ਸੀ ਪਤਾ ਦਿੱਲੀ ਤੋਂ ਆਉਣ ਦਾ ਰਸਤਾ ਕਿਹੜਾ ਰਸਤਾ ਸਾਫ ਹੈ ਕਿਹੜਾ ਰਸਤਾ ਸਾਡੇ ਲਈ ਵਧੀਆ ਹੈ ਕਿਉਂਕਿ ਰਾਤ ਦਾ ਟਾਈਮ ਸੀਗਾ ਤਾਂ ਟਰੈਫਿਕ ਵੀ ਉਸ ਹਿਸਾਬ ਨਾਲ ਸੀਗੀ ਹਾਂਜੀ ਸਰ ਤੁਹਾਡਾ ਬਹੁਤ ਬਹੁਤ ਜੀ ਤੁਸੀਂ ਬਹੁਤ ਵਧੀਆ ਵਿਵਹਾਰ ਕੀਤਾ ਹਾਂਜੀ ਹਾਂਜੀ ਹਾਂਜੀ ਸਰ ਤੁਹਾ ਕਿ ਤੁਹਾਨੂੰ ਪਤਾ ਹੀ ਹੈ ਜੀ ਮੇਰੇ ਨਾਲ ਮੇਰੇ ਬਜ਼ੁਰਗ ਮਾਤਾ ਪਿਤਾ ਵੀ ਸਨ ਅਤੇ ਛੋਟੇ ਬੱਚੇ ਵੀ ਸਨ ਹਾਂਜੀ ਅਤੇ ਉਹਨਾਂ ਲਈ ਇੱਥੇ ਆਉਣਾ ਬਹੁਤ ਜ਼ਿਆਦਾ ਮੁਸ਼ਕਲ ਸੀ ਪਰ ਤੁਸੀਂ ਸਾਨੂੰ ਬਹੁਤ ਵਧੀਆ ਢੰਗ ਨਾਲ਼ ਇੱਥੇ ਪਹੁੰਚਾਇਆ ਰਸ ਹਾਂਜੀ ਰਸਤੇ 'ਚ ਕੋਈ ਸਾਨੂੰ ਇੱਦਾਂ ਦੀ ਮੁਸ਼ਕਲ ਨਹੀਂ ਆਈ ਕਿ ਸਾਨੂੰ ਮੇਰੇ ਮਾਤਾ ਪਿਤਾ ਨੂੰ ਜਾਂ ਫਿਰ ਛੋਟੇ ਬੱਚਿਆਂ ਨੂੰ ਕੋਈ ਇੱਦਾਂ ਦੀ ਦਿੱਕਤ ਆਏ ਹਾਂ ਤੁਹਾਡੇ ਇਸ ਤੁਹਾਡੇ ਇਸ ਇਸ ਕਾ ਇਸ ਕਰਕੇ ਅਸੀਂ ਬਹੁਤ ਵਧੀਆ ਤਰੀਕੇ ਨਾਲ਼ ਇੱਥੇ ਪਹੁੰਚ ਗਏ ਹਾਂਜੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇੱਕ ਨਵੇਂ ਸ਼ਹਿਰ 'ਚ ਕਿਉਂਕਿ ਸਾਨੂੰ ਤਾਂ ਰਸਤਾ ਪਤਾ ਹੀ ਨਹੀਂ ਸੀਗਾ ਨਾ ਜੀ ਕਿੱਦਾਂ ਕਿੱਥੋਂ ਆਉਣਾ ਕਿੱਥੇ ਜਾਣਾ ਕਿੱਧਰ ਟਰੈਫਿਕ ਘੱਟ ਹੈ ਕਿੱਦਾਂ ਹੈ ਹਾਂਜੀ ਅਤੇ ਤੁਸੀਂ ਜਿਹੜਾ ਤੁਹਾਡਾ ਵਿਵਹਾਰ ਹੈ ਸਰ ਬਹੁਤ ਵਧੀਆ ਹੈ ਜੀ ਬਹੁਤ ਨਿਮਰਤਾ ਵਾਲਾ ਹੈ ਅਤੇ ਮੇਰੇ ਮਾਤਾ ਪਿਤਾ ਨੂੰ ਵੀ ਬਹੁਤ ਪਸੰਦ ਆਏ ਤੁਹਾਡਾ ਵਿਵਹਾਰ ਬਹੁਤ ਬਹੁਤ ਧੰਨਵਾਦ ਜੀ